ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਉੱਥੇ ਗੱਲ ਕਰਦੇ ਪਏ ਹਾਂ ਹਾਂਜੀ ਪਹਿਲਾਂ ਤਾਂ ਮੈਮ ਤੁਹਾਡਾ ਨਾਮ ਕੀ ਆ ਅਤੇ ਤੁਸੀਂ ਇਥੋਂ ਕਪੂਰਥਲੇ ਦੇ ਲੋਕਲ ਹੀ ਹੋ ਅੱਛਾ ਅਤੇ ਮੈਮ ਤੁਸੀਂ ਕਿੱਦਾਂ ਦੇ ਫੰਕਸ਼ਨ ਵਾਸਤੇ ਹੇਅਰ ਸਟਾਈਲ ਕਰਾਉਣਾ ਚਾਹੁੰਦੇ ਹੋ ਓ ਅੱਛਾ ਮੈਮ ਸਾਡੇ ਕੋਲ ਡਿਫਰੈਂਟ ਡਿਫਰੈਂਟ ਉੱਦਾਂ ਤੋਂ ਪੈਕਜਿਸ ਹੁੰਦੇ ਆ ਹੇਅਰ ਸਟਾਈਲ ਦੇ ਬਈ ਜੇ ਤਾਂ ਤੁਸੀਂ ਹੈਵੀ ਕਰਾਉਣਾ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਇੰਗੇਜਮੈਂਟ ਪਾਰਟੀ ਆ ਤਾਂ ਉਹਦੇ ਵਾਸਤੇ ਤੋਂ ਪੈਕਿਜਿਜ ਹੁੰਦੇ ਆ ਪੰਦਰਾਂ ਸੌ ਤੋਂ ਲੈ ਕੇ ਤਿੰਨ ਹਜ਼ਾਰ ਤੱਕ ਵੀ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦਾ ਹੇਅਰ ਸਟਾਈਲ ਕਰਾ ਰਹੇ ਹੋ ਕਿਹੜੀ ਕਿਹੜੀ ਅਸੈਸਰੀਜ਼ ਔਰ ਪ੍ਰੋਡਕਟ ਦਾ ਯੂਜ ਕਰਦੇ ਪਏ ਆ ਉਸ ਹਿਸਾਬ ਨਾਲ ਪੈਕੇਜਜ ਆਉਂਦੇ ਉੱਦਾਂ ਨੋਰਮਲ ਵੀ ਅਸੀਂ ਪਾਰਟੀ 'ਤੇ ਕਰ ਦਿੰਦੇ ਆ ਉਹ ਪੈ ਜਾਂਦਾ ਵਾ ਸਾਡਾ ਅੱਠ ਸੌ ਤੋਂ ਹਜ਼ਾਰ ਦੇ ਵਿੱਚ ਵਿੱਚ ਦਾ ਮੈਮ ਤੁਹਾਡੇ ਅਸੀਂ ਵੈਸੇ ਤੁਹਾਡੀ ਵੀ ਲਾ ਸਕਦੇ ਹੋ ਬਟ ਕਿਉਂਕਿ ਹੁਣ ਅਸੀਂ ਤੁਹਾਡਾ ਹੇਅਰ ਸਟਾਈਲ ਕਰਨਾ ਵਾ ਤਾਂ ਸਾਡੇ ਕੋਲ ਵੀ ਹਰ ਵਰਾਇਟੀ ਹੁੰਦੀ ਆ ਔਰ ਜ਼ਿਆਦਾਤਰ ਜਿਹੜੇ ਵੀ ਸਾਡੇ ਕਸਟਮਰ ਹੁੰਦੇ ਆ ਉਹ ਸਾਡੀਆਂ ਹੀ ਲਾ ਕੇ ਜਾਂਦੇ ਆ ਉਹਨਾਂ ਦੇ ਵਿੱਚ ਹੀ ਕੋਸਟ ਆ ਜਾਂਦਾ ਜਿੱਦਾਂ ਮੈਂ ਤੁਹਾਨੂੰ ਪੇਕੇਜਿਜ ਦੱਸੇ ਆ ਨਾ ਉਹਦੇ ਦਿਨ ਉਹਦੇ ਅੰਦਰ ਹੀ ਅੰਦਰ ਤੁਹਾਡਾ ਸਾਰਾ ਖਰਚਾ ਇਹਨਾਂ ਅਸੈਸਰੀਜ਼ ਦਾ ਵੀ ਨਿਕਲ ਜਾਊਗਾ ਔਰ ਤੁਸੀਂ ਬਾਅਦ 'ਚੋਂ ਉਹਨੂੰ ਲੈ ਕੇ ਵੀ ਜਾ ਸਕਦੇ ਹੋ ਆਪਣੇ ਨਾਲ ਹਾਂਜੀ ਅਸੀਂ ਉੱਦਾਂ ਜ਼ਿਆਦਾਤਰ ਲੋਰੀਅਲ ਦੇ ਯੂਜ ਕਰਦੇ ਆ ਉਹ ਡਿਪੈਂਡ ਜਿੱਦਾਂ ਤੁਸੀਂ ਹੁਣ ਪੈਕੇਜਜ ਦਾ ਲਵੋਗੇ ਨਾ ਉਹਦੇ 'ਤੇ ਹੁੰਦਾ ਵਾ ਜਿਵੇਂ ਹੁਣ ਜ਼ਿਆਦਾਤਰ ਤਿੰਨ ਹਜ਼ਾਰ ਵਾਲੇ ਪੈਕਟ 'ਚ ਅਸੀਂ ਸਾਰੇ ਇੰਪੋਰਟੈਂਟ ਜਿਹੜੇ ਵਧੀਆ ਵਾਲੇ ਹੁੰਦੇ ਆ ਕੈਮੀਕਲ ਫਰੀ ਉਹ ਯੂਜ ਕਰਦੇ ਆ ਜਿਵੇਂ ਕਿ ਲੋਰੀਆਲ ਹੋ ਗਿਆ ਲੈਕਮੇ ਹੋ ਗਿਆ ਬਾਕੀ ਅਗਰ ਤੁਹਾਡੇ ਕੋਈ ਖੁਦ ਦੀ ਰਿਕਵਾਇਰਮੈਂਟ ਆ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਨੂੰ ਹਾਂਜੀ ਉਹਦੇ ਵੀ ਹੈਗੇ ਆ ਜਿੱਦਾਂ ਤੁਸੀਂ ਕਹਿ ਰਹੇ ਸੀ ਉਦੋਂ ਹੀ ਮੰਗਵਾ ਕੇ ਤੁਹਾਡਾ ਉਹਦੇ ਨਾਲ ਵੀ ਕਰ ਸਕਦੇ ਹਾਂ ਚਾਰਜਿਜ ਮੈਮ ਹੁਣ ਤੁਸੀਂ ਦੱਸੋ ਤੁਹਾਡੀ ਜਿੱਦਾਂ ਤੁਸੀਂ ਕਹਿ ਦੇਵੋਗੇ ਉੱਦਾਂ ਸਾਡੇ ਫਿਕਸ ਹੀ ਹੁੰਦੇ ਆ ਅਸੀਂ ਜ਼ਿਆਦਾ ਕਰਦੇ ਨਹੀਂ ਆ ਤੁਹਾਨੂੰ ਵਧੀਆ ਹੀ ਲੱਗੂਗਾ ਜੋ ਅਸੀਂ ਹੇਅਰ ਸਟਾਈਲ ਕਰਦੇ ਹਾਂ ਤੁਹਾਡੇ ਕੋਲ ਤੁਸੀਂ ਮੈਮ ਇੰਸਟਾਗ੍ਰਾਮ 'ਤੇ ਹੈਗੇ ਆ ਤੁਸੀਂ ਸਾਡੇ ਆਈ ਐਟੀਟਿਊਡ ਸਲੋਨ ਕਪੂਰਥਲਾ ਪਾ ਦਿਓ ਉਹਦੇ 'ਚ ਦੇਖੋ ਅਸੀਂ ਸਾਰੇ ਉਹਦੇ 'ਚ ਰੱਖਦੇ ਆ ਔਰ ਤੁਹਾਨੂੰ ਵਧੀਆ ਹੀ ਲੱਗੂਗਾ ਸਾਡੇ ਸਾਰੇ ਜਿੰਨੇ ਵੀ ਕਸਟਮਰ ਆ ਉਹਨਾਂ ਦੇ ਵਧੀਆ ਹੀ ਰਿਵਿਊ ਆਉਂਦੇ ਆ ਨਹੀਂ ਇੱਕੋ ਹੀ ਹੈ ਸਾਡੀ ਜਿੱਥੇ ਸ਼ਾਲੀਮਾਰ ਬਾਗ਼ ਹੈ ਨਾ ਮੈਮ ਉਹਦੀ ਗਲੀ ਨੰਬਰ ਤਿੰਨ ਜਿੱਥੇ ਕੁ ਸਾਡਾ ਕੇ ਐੱਫ ਸੀ ਪੈ ਜਾਂਦਾ ਵਾ ਉਹਦੇ ਬਿਲਕੁਲ ਨਾਲ ਵਾਲੀ ਨਾਲ ਹੀ ਆ ਬਿਲਕੁਲ ਸਾਡਾ ਪਰ ਇੱਕ ਹੀ ਆ ਸਾਡਾ ਇੱਕ ਹੀ ਆ ਪੂਰੇ ਕਪੂਰਥਲੇ ਵਿੱਚ ਇੱਕ ਹੀ ਸਾਨੂੰ ਮਿਲੀ ਆ ਫਰੈਂਚੀਸ ਹਾਂਜੀ ਹਾਂਜੀ ਤੁਸੀਂ ਦੱਸ ਦਿਓ ਅਤੇ ਮੈਮ ਬਾਕੀ ਜਿਹੜਾ ਵੀ ਸਾਡਾ ਹੁਣ ਜਿਹੜਾ ਮੇਰਾ ਨੰਬਰ ਆ ਇਹਦੇ 'ਤੇ ਆਪਣੇ ਸਾਰੀ ਡਿਟੇਲ ਵਗੈਰਾ ਸਭ ਭੇਜ ਦਿਓ ਅਤੇ ਮੈਮ ਆਪਣੀ ਜੋ ਤੁਸੀਂ ਡਰੈਸ ਪਾਵੋਗੇ ਇਸ ਪੋਸੀਬਲ ਤਾਂ ਤੁਸੀਂ ਪਲੀਜ਼ ਆਪਣੀ ਉਸ ਡਰੈਸ ਦੀ ਵੀ ਸਾਰੀ ਫੋਟੋਆਂ ਅਤੇ ਤੁਹਾਡੇ ਬਾਕੀ ਤੁਹਾਡੀ ਜਿਹੜੀ ਅਸੈਸਰੀਜ਼ ਆ ਉਹਦੇ ਵੀ ਫੋਟੋਆਂ ਸਾਨੂੰ ਭੇਜ ਦਿਓ ਤਾਂ ਅਸੀਂ ਉਸ ਹਿਸਾਬ ਨਾਲ ਓਕੇ ਮੈਮ ਫਿਰ ਤੁਸੀਂ ਹਾਂਜੀ ਫਿਰ ਤੁਸੀਂ ਆਪਣੇ ਡਰੈਸ ਦੀ ਫੋਟੋ ਸਾਨੂੰ ਭੇਜ ਦਿਓ ਹਾਂਜੀ ਹਾਂਜੀ ਓਕੇ ਮੈਮ ਥੈਂਕ ਯੂ ਮੈਮ